ਮੈਂ ਬਚਪਨ ਤੋਂ ਹੀ ਚਿੱਤਰਕਾਰੀ ਕਰ ਰਹੀਂ ਹਾਂ ਮੈਨੂੰ ਦੇਖ ਕੇ ਮੇਰਾ ਭਾਈ ਵੀ ਚਿੱਤਰਕਾਰੀ ਕਰ ਰਿਹਾ ਹੈ ਉਸਨੇ ਥੋੜ੍ਹੀ ਬਹੁਤੀ ਚਿੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਉਹ ਅਜੇ ਇੰਨਾਂ ਅਭਿਆਸੀ ਨਹੀਂ ਹੈ ਉਸਨੂੰ ਅਜੇ ਚਿੱਤਰਕਾਰੀ ਬਾਰੇ ਇੰਨੀ ਨੋਲੇਜ ਨਹੀਂ ਹੈ ਉਹ ਮੈਨੂੰ ਦੇਖ ਦੇਖ ਕੇ ਹੀ ਕਰਦਾ ਹੈ ਅਤੇ ਉਸਨੂੰ ਰੰਗ ਮਿਲਾਉਣ ਦੀ ਵੀ ਕੋਈ ਨੋਲੇਜ ਨਹੀਂ ਹੈ ਉਹ ਗਲਤ ਰੰਗ ਮਿਲਾ ਦਿੰਦਾ ਹੈ ਅਤੇ ਮੈਂ ਇਹੀ ਚਾਹੁੰਗੀ ਕਿ ਮੈਂ ਉਸਨੂੰ ਰੰਗ ਮਿਲਾਉਣ ਬਾਰੇ ਚੰਗਾ ਨੋਲੇਜ ਦੇ ਸਕਾਂ ਕਿ ਰੰਗ ਕਿਸ ਤਰ੍ਹਾਂ ਮਿਲਾਉਣੇ ਹਨ ਅਤੇ ਰੰਗਾਂ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ ਤਾਂ ਜੋ ਉਹ ਵੱਡਾ ਹੋ ਕੇ ਇੱਕ ਅੱਛਾ ਚਿੱਤਰਕਾਰ ਬਣ ਸਕੇ ਅਤੇ ਮੈਂ ਇਹ ਹੁਨਰ ਸ ਹੁਨਰ ਨੂੰ ਸੁਧਾਰਨ ਵਿੱਚ ਉਸਦਾ ਬਹੁਤ ਮਦਦ ਕਰੁੰਗੀ